ਹੈਲੋ ਸਰ ਤੁਸੀਂ ਫਲਿੱਪਕਾਰਟ ਤੋਂ ਬੋਲਦੇ ਪਏ ਜੇ ਮੈਂ ਤੁਹਾਡੇ ਫਲਿੱਪਕਾਰਟ ਤੋਂ ਔਡ ਔਡਰ ਕੀਤੀ ਹੈ ਇੱਕ ਡਰੈੱਸ ਇੱਕ ਪਰਸ ਡਰੈੱਸ ਤਾਂ ਖ਼ਰਾਬ ਨਿਕਲੀ ਪਰ ਇਹ ਕਿ ਪਰਸ ਬਹੁਤ ਵਧੀਆ ਨਿਕਲਿਆ ਡਰੈੱਸ ਵਿੱਚ ਰੰਗ ਵੀ ਉਹਦਾ ਖ਼ਰਾਬ ਨਿਕਲਿਆ ਧੋਤਿਆਂ ਖ਼ਰਾਬ ਹੋ ਗਈ ਦੂਜੀ ਗੱਲ ਇਹ ਵਾ ਕਿ ਉਹ ਫਟੀ ਵੀ ਸੀ ਸਾਈਡ ਤੋਂ ਪਹਿਲਾਂ ਜਿਹੜੀ ਡਰੈੱਸ ਔਡਰ ਕੀਤੀ ਸੀ ਉਹ ਤਾਂ ਬੜੀ ਵਧੀਆ ਨਿਕਲੀ ਪਰ ਇਹ ਜਿਹੜੀ ਡਰੈੱਸ ਇਹਦੀ ਤੁੰਬ ਵੀ ਤੁੰਬ ਵੀ ਨਿਕਲੀ ਇੱਕ ਸਾਈਡ ਤੋਂ ਇਹਦਾ ਸਾਈਜ਼ ਵੀ ਪੂਰਾ ਨਹੀਂ ਹੈਗਾ ਪਰ ਇਹ ਹੈ ਕਿ ਅਸੀਂ ਜਿਹੜੀ ਦੁਬਾਰਾ ਇਹਨੂੰ ਵਾਪਸ ਭੇਜਿਆ ਸੀਗਾ ਉਹ ਫੇਰ ਤੁਸੀਂ ਵੱਡੀ ਡਰੈੱਸ ਨਹੀਂ ਭੇਜੀ ਬੱਚਿਆਂ ਨੂੰ ਛੋਟੀ ਆਈ ਆ ਫੇਰ ਫਟੀ ਹੋਈ ਵੀ ਨਿਕਲੀ ਇਹਦਾ ਰੰਗ ਵੀ ਬਹੁਤ ਖ਼ਰਾਬ ਆ ਪਹਿਲਾਂ ਇੱਦਾਂ ਦੀਆਂ ਡਰੈੱਸਾਂ ਤੁਸੀਂ ਨਹੀਂ ਭੇਜਦੇ ਹੁੰਦੇ ਪਰ ਇਹ ਆ ਕਿ ਆਹ ਡਰੈੱਸ ਬਹੁਤ ਮਾੜੀ ਨਿਕਲੀ ਪਹਿਲਾਂ ਵੀ ਤਿੰਨ ਔਡਰ ਕਰੀਦੀਆਂ ਡਰੈੱਸਾਂ ਬੜੀਆਂ ਵਧੀਆ ਮਿਲਦੀਆਂ ਹੁੰਦੀਆਂ ਸੀ ਪਰ ਇਹਦਾ 'ਤੇ ਸਾਈਜ਼ ਵੀ ਨਹੀਂ ਹੈਗਾ ਆਇਆ ਵੀ ਇਹ ਬੜੀ ਐਂ ਫਟੀ ਜਿਹੀ ਇਹਦੀ ਕੁਆਲਿਟੀ ਕੋਈ ਨਹੀਂ ਹੈਗੀ ਇੱਦਾਂ ਦੀ ਡਰੈੱਸ ਫੋ ਫੋਟੋ ਤਾਂ ਹੈਗੀ ਨਹੀਂ ਹੀ ਜਿੱਦਾਂ ਦੀ ਤੁਸੀਂ ਹੁਣ ਭੇਜ ਦਿੱਤੀ ਹੈ ਇੱਕ ਤਾਂ ਛੋਟੀ ਨਿਕਲੀ ਹੈ ਅਤੇ ਦੂਜੀ ਗੱਲ ਇਹ ਕਿ ਇਹਦਾ ਸਾਈਜ਼ ਵੀ ਪੂਰਾ ਨਹੀਂ ਆਇਆ ਵੇ ਅਤੇ ਇਹ ਵਾਪਸ ਹੁਣ ਸਾਨੂੰ ਫਿਰ ਦੁਬਾਰਾ ਭੇਜਣੀ ਪੈਣੀ ਹੈ ਅਤੇ ਫਿਰ ਹੁਣ ਡਰੈੱਸ ਚੰਗੀ ਭੇਜਿਓ